ਹੈਲੋ ਹਾਂਜੀ ਜਸਵਿੰਦਰ ਜੀ ਬੋਲਦੇ ਹਾਂਜੀ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਮੈਂ ਬਾਹਰ ਇੱਥੇ ਤੋਂ ਆਇਆਂ ਆਪਣਾ ਯੂ ਪੀ ਸਾਈਡ ਤੋਂ ਐਧਰੋਂ ਇੱਧਰ ਅਤੇ ਮੈਂ ਨਾ ਇੱਥੇ ਮਤਲਬ ਖਰੜ ਦੇ ਨੇੜ ਇੱਥੇ ਆਪਣਾ ਰਹਿਣਾ ਦਸ ਦਸ ਕੁ ਦਿਨ ਲਈ ਇੱਥੇ ਮੈਨੂੰ ਪਾਲ ਢਾਬੇ ਬਾਰੇ ਦੱਸਿਆ ਜੀ ਕਿਸੇ ਨੇ ਉਹਦੇ ਬਾਰੇ ਪੁੱਛਣਾ ਸੀ ਵੀ ਕੀ ਸਿਸਟਮ ਹੈ ਇੱਥੇ ਮਤਲਬ ਕਿੱਦਾਂ ਦਾ ਤੁਹਾਨੂੰ ਇਹਦੀ ਨੌਲੇਜ ਹੈ ਇਹਦੇ ਬਾਰੇ ਹਾਂਜੀ ਨਹੀਂ ਬ ਮਤਲਬ ਇੱਥੇ ਮਤਲਬ ਵਧੀਆ ਖਾਣ ਪੀਣ ਲਈ ਮਿਲਦਾ ਕਿਸੇ ਨੇ ਦੱਸਿਆ ਸੀ ਕਹਿੰਦੇ ਬਾਕੀ ਹੋਟਲਾਂ 'ਚ ਤਾਂ ਇੱਦਾਂ ਮਤਲਬ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਚਿਕਨ ਚੁਕਨ ਹਰ ਵਰਾਇਟੀ ਹੈਗੀ ਤੁਹਾਡੇ ਕੋਲ ਹੈਂ ਇਹਨਾਂ ਕੋਲ ਹੈਂ ਅੱਛਾ ਅੱਛਾ ਅੱਛਾ ਜੀ ਤਾਂ ਹੀ ਬਾਕੀ ਤਾਂ ਪਤਾ ਰਹਿੰਦਾ ਅੱਛਾ ਅੱਛਾ ਅੱਛਾ ਜੀ ਚਲੋ ਠੀਕ ਹੈ ਜੀ ਤੁਸੀਂ ਇੱਧਰ ਦੇ ਨਾਲ਼ੇ ਲਾਗੇ ਦੇ ਰਹਿਣ ਵਾਲੇ ਇੱਥੇ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਜੀ ਮੈਂ ਵੀ ਪੰਜ ਸੱਤ ਦਿਨਾਂ ਲਈ ਇੱਥੇ ਆਉਣਾ ਸੀ ਤਾਂ ਕਰਕੇ ਮੈਂ ਪੁੱਛ ਰਿਹਾ ਸੀ ਮੈਂ ਹਾਂ ਚੱਲ ਪਤਾ ਲੱਗ ਜਾਵੇ ਚਲੋ ਠੀਕ ਹੈ ਓਕੇ ਓਕੇ ਥੈਂਕ ਯੂ ਭਾਅ ਜੀ ਹੈਂ